ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਭਾਅ ਜੀ ਇੱਕ ਨਾ ਮੈਂ ਨਵੇਂ ਇੱਥੇ ਰੈਜੀਡੈਂਟ ਆਏ ਹਾਂ ਅਤੇ ਮੈਨੂੰ ਨਾ ਇੱਕ ਮਦਦ ਚਾਹੀਦੀ ਸੀ ਕਿ ਮੈਨੂੰ ਮੈਡੀਕਲ ਮੈਡੀਕਲ ਫਸਿਲਿਟੀਸ ਦੇ ਬਾਰੇ ਪੁੱਛਣਾ ਸੀ ਕਿ ਮੈਨੂੰ ਕਿੱਦਾਂ ਮਿਲ ਸਕਦੀ ਇੱਥੇ ਠੀਕ ਹੈ ਜੀ ਓਕੇ ਧੰਨਵਾਦ ਜੀ